ਬਰਤਨ ਧੋਣ ਦੀ ਪ੍ਰਕਿਰਿਆ ਬਹੁਤ ਹੀ ਆਮ ਹੈ ਅਤੇ ਹਰ ਰੋਜ਼ ਦੀ ਜ਼ਿੰਦਗੀ ਵਿੱਚ ਵਰਤੀ ਜਾਂਦੀ ਹੈ ਇਸ ਵਿੱਚ ਕੁਛ ਮੁੱਖ ਕਦਮ ਸ਼ਾਮਿਲ ਹੁੰਦੇ ਹਨ ਬਰਤਨ ਨੂੰ ਰੁੱਖੇ ਕਰਨਾ ਸਭ ਤੋਂ ਪਹਿਲਾਂ ਬਰਤਨ ਨੂੰ ਸਿੱਧਾ ਸਾਫ ਕਰਨ ਤੋਂ ਪਹਿਲਾਂ ਧੋ ਕੇ ਰੱਖਣਾ ਚਾਹੀਦਾ ਹੈ ਤਾਂ ਜੋ ਖਾਣ ਪੀਣ ਦੇ ਬਾਕੀ ਟੁਕੜੇ ਦੂਰ ਹੋ ਸਕਣ ਪਾਣੀ ਅਤੇ ਸਾਬਣ ਦੀ ਵਰਤੋਂ ਸਾਫ ਕਰਨ ਲਈ ਗਰਮ ਪਾਣੀ ਅਤੇ ਸਾਬਣ ਦੀ ਵਰਤੋਂ ਕੀਤੀ ਜਾਂਦੀ ਹੈ ਗਰਮ ਪਾਣੀ ਤੇਲ ਤੇ ਮਿੱਟੀ ਨੂੰ ਢੇਈ ਕਰਦਾ ਹੈ ਜਿਸ ਨਾਲ ਬਰਤਨ ਸਾਫ ਹੋਣਾ ਸੌਖਾ ਹੋ ਜਾਂਦਾ ਹੈ ਬਰਤਨ ਨੂੰ ਰਗੜਨਾ ਬਰਤਨ ਨੂੰ ਸਾਫ ਕਰਨ ਲਈ ਜਨਰਲ ਰਗੜ ਵਾਲੇ ਪੈਡ ਜਾਂ ਬ੍ਰਸ਼ ਦੀ ਵਰਤੋ ਕੀਤੀ ਜਾਂਦੀ ਹੈ ਹਲਕਾ ਕਮੀਲ ਦੀ ਵਰਤੋਂ ਕਈ ਵਾਰੀ ਖਾਸ ਤੇਲ ਵਾਲੇ ਬਰਤਨ ਜਿਵੇਂ ਕਿ ਭੰਨ ਤਵਾ ਜਾਂ ਫਰਾਈ ਪੈਨ ਨੂੰ ਧੋਣ ਲਈ ਹਲਕਾ ਬੇਕਿੰਗ ਸੋਢਾ ਜਾਂ ਸਲੀਟ ਦੀ ਵਰਤੋਂ ਕੀਤੀ ਜਾਂਦੀ ਹੈ ਜੋ ਤੇਲ ਨੂੰ ਸਾਫ ਕਰਦਾ ਹੈ ਅਤੇ ਖੁਸ਼ਬੂ ਵੀ ਦੂਰ ਕਰਦਾ ਹੈ ਤੇਲ ਵਾਲੇ ਬਰਤਨਾਂ ਨੂੰ ਸਾਫ ਕਰਨ ਲਈ ਕੁਛ ਨੁਕਤੇ ਬੇਕਿੰਗ ਸੋਡਾ ਤੇਲ ਨੂੰ ਖਿੱਚ ਕੇ ਸਾਫ ਕਰਦਾ ਹੈ ਇਸ ਨੂੰ ਪਾਣੀ ਵਿੱਚ ਮਿਲਾ ਕੇ ਬਰਤਨ ਤੇ ਲਗਾ ਸਕਦੇ ਹਾਂ